ਹਾਂਜੀ ਅਸੀਂ ਸਾਨੂੰ ਵਕੀਲ ਉਸ ਪੰਚਾਇਤ ਦੇ ਦਫ਼ਤਰਾਂ ਵਿੱਚ ਬਹੁਤ ਤਰ੍ਹਾਂ ਦੇ ਧੱਕੇ ਖਾਣੇ ਪੈਂਦੇ ਇਸ ਕਰਕੇ ਸਾਨੂੰ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਜੋ ਆਪਾਂ ਗੱਲਾਂ ਲੋਕਾਂ ਪੰਚਾਇਤ ਵਿੱਚ ਬਹਿ ਕੇ ਕਰ ਸਕਦੇ ਹਾਂ ਉਹ ਜਦੋਂ ਉਹ ਆਪਾਂ ਨੂੰ ਵਕੀਲਾਂ ਦੁਆਰਾ ਪਤਾ ਵਕੀਲਾਂ ਦੁਆਰਾ ਲੈ ਕੇ ਜਾਂਦੇ ਹਾਂ ਅਤੇ ਉਹਦੇ ਵਿੱਚ ਆਪਾਂ ਨੂੰ ਬਹੁਤ ਧੱਕੇ ਖਾਣੇ ਪੈਂਦੇ ਅਤੇ ਭ੍ਰਿਸ਼ਟਾਚਾਰ ਉਹ ਉਹ ਜ਼ਿਆਦਾਤਰ ਭ੍ਰਿਸ਼ਟਾਚਾਰ ਹੀ ਫੈਲਾਉਂਦੇ ਨੇ